ਮੀਡੀਆ ਵਿੱਚ ਦਿਖਾਏ ਜਾਣ ਵਾਲੇ ਇਸ਼ਤਿਹਾਰਾਂ ਬਾਰੇ ਮੇਰਾ ਇਹ ਵਿਚਾਰ ਹੈ ਕਿ ਮੈਂ ਇੱਕ ਵਾਰੀ ਇਸ਼ਤਿਹਾਰ ਪੜ੍ਹਿਆ ਜਿਸ ਵਿੱਚ ਦੱਸਿਆ ਗਿਆ ਸੀ ਕਿ ਅਧਿਆਪਕ ਬਾਰੇ ਬਹੁਤ ਸਾਰੀਆਂ ਪੋਸਟਾਂ ਨਿਕਲੀਆਂ ਹਨ ਮੈਂ ਇਸ਼ਤਿਹਾਰ ਪੜ੍ਹ ਕੇ ਜਦੋਂ ਅੰਮ੍ਰਿਤਸਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਅਧਿਆਪਕ ਦੀ ਪੋਸਟ ਲਈ ਗਈ ਤਾਂ ਉੱਥੇ ਮੈਨੂੰ ਮੈਡਮ ਨੇ ਦੱਸਿਆ ਕਿ ਇੱਥੇ ਕੋਈ ਵੀ ਸੀਟ ਖਾਲੀ ਨਹੀਂ ਹੈਗੀ ਮੈਂ ਉਹਨਾਂ ਨੂੰ ਦੱਸਿਆ ਕਿ ਮੈਂ ਤਾਂ ਅਖ਼ਬਾਰ ਵਿੱਚ ਪੜ੍ਹਿਆ ਸੀ ਹੁਣ ਤਾਂ ਮੇਰਾ ਅਖਬਾਰ ਵਿੱਚ ਬਲਕਿ ਹੁਣ ਮੇਰਾ ਅਖ਼ਬਾਰ ਤੋਂ ਭਰੋਸਾ ਹੀ ਉੱਠ ਗਿਆ ਹੈ ਜਿ ਜਿਸ ਵਿੱਚ ਸਾਰਾ ਕੁਝ ਹੀ ਝੂਠ ਦੱਸਿਆ ਜਾਂਦਾ ਹੈ ਦੂਸਰੀ ਗੱਲ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦੀ ਹਾਂ ਕਿ ਮੈਂ ਇੱਕ ਇਸ਼ਤਿਹਾਰ ਹੋਰ ਪੜ੍ਹਿਆ ਸੀ ਲੜਕੇ ਬਾਰੇ ਜੋ ਕਿ ਜਦਕਿ ਮੇਰੇ ਘਰਦਿਆਂ ਨੇ ਲੜਕਾ ਲੱਭ ਲਿਆ ਸੀਗਾ ਉਸ ਵਿੱਚ ਲਿਖਿਆ ਸੀ ਕਿ ਲੜਕਾ ਪੱਚੀ ਸਾਲ ਦਾ ਹੈ ਅਤੇ ਉਹ ਪੀ ਐਚ ਡੀ ਡਾਕਟਰੀ ਵੀ ਕਰ ਲਿਆ ਹੈ ਏਦਾਂ ਕਿਵੇਂ ਹੋ ਸਕਦਾ ਹੈ ਐਨੀ ਛੋਟੀ ਉਮਰ ਵਿੱਚ ਲੜਕੇ ਨੇ ਨੌਕਰੀ ਕਰ ਲਈ ਇਸ ਲਈ ਮੈਨੂੰ ਇਹ ਬਹੁਤ ਭਟਕਣ ਵਾਲੇ ਇਸ਼ਤਿਹਾਰ ਦਿੰਦੇ ਹਨ